ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਕਿੱਥੋਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਬੀਏ 'ਚ

ਸਮਝ ਗਿਆ ਸਮਝ ਗਿਆ ਸਮਝ ਗਿਆ ਮੈਂ ਆਪਣੇ ਕੋਲ ਬੇਟੇ ਬੀਏ 'ਚ ਅੱਛਾ ਅੱਛਾ ਅਤੇ ਕਿਹੜਾ 'ਚ ਆਪਣਾ ਇੰਟਰਸਟ ਵੱਧ ਹੈ ਜਾਂ ਹਲੇ ਵੈਸੇ ਵੇਖ ਰਹੇ ਪੰਜਾਬੀ ਲਿਟਰੇਚਰ 'ਚ ਠੀਕ ਹੈ ਠੀਕ ਹੈ ਠੀਕ ਹੈ ਬੱਚੇ ਐੱਮਏ ਤਾਂ ਚਲੋ ਸਾਰੀਆਂ ਅਵੇਲੇਬਲ ਨੇ ਆਪਣੀ ਯੂਨੀਵਰਸਿਟੀ ਦੇ ਵਿੱਚ ਅਤੇ ਆਪਣੇ ਕਿੰਨੇ ਮਾਕਸ ਆਏ ਨੇ ਆਪਣੇ ਪ੍ਰਸੈਂਟੇਜ ਕਿੰਨੀ ਹੈ ਬੀਏ 'ਚ ਪਚਵੰਜਾ ਪ੍ਰਸੈਂਟ ਅੱਛਾ ਇੱਦਾਂ ਕਿ ਪਚਵੰਜਾ ਪ੍ਰਸੈਂਟ ਦੇ ਵਿੱਚ ਆਪਾਂ ਅਪਲਾਈ ਤਾਂ ਕਰ ਸਕਦੇ ਹਾਂ ਸਾਰੇ ਕਿਤੇ ਕੋਈ ਵੀ ਐੱਮਏ ਚਾਹੇ ਹਿਸਟਰੀ ਹੋਵੇ ਚਾਹੇ ਪੋਲੀਟਿਕਲ ਸਾਇੰਸ ਹੋਵੇ ਚਾਹੇ ਪੰਜਾਬੀ ਲਿਟਰੇਚਰ ਹੈ ਠੀਕ ਹੈ ਆਪਲਾਈ ਆਪਾਂ ਕਰ ਸਕਦੇ ਹਾਂ ਬਟ ਉਸ ਤੋਂ ਬਾਅਦ ਕੌਸਲਿੰਗ ਹੁੰਦੀ ਆ ਕੌਸਲਿੰਗ ਦਾ ਮਤਲਬ ਹੈ ਕਿ ਉਹਦੀਆਂ ਇੱਕ ਵਾਰੀ ਸਾਰੀ ਪ੍ਰਸੈਂਟਜ ਚੱਕ ਕੇ ਜਿੰਨੀਆਂ ਸੀਟਸ ਨੇ ਜਿਵੇਂ ਪੋਲੀਟੀਕਲ ਸਾਇੰਸ ਦੇ ਵਿੱਚ ਫਿਫਟੀ ਫਾਈਵ ਸੀਟਸ ਨੇ ਇਸੇ ਤਰੀਕੇ ਨਾਲ ਪੰਜਾਬੀ ਡਿਪਾਰਟਮੈਂਟ 'ਚ ਵੀ ਐੱਮਏ ਦੀਆਂ ਸੀਟਸ ਨੇ ਸੀਟਸ ਦੇ ਅਕੋਡਿੰਗਲੀ ਜਿਹੜੇ ਬੱਚਿਆਂ ਦੀ ਵੱਧ ਪ੍ਰਸੈਂਟਜ ਹੁੰਦੀ ਹੈ ਐਡਮਿਸ਼ਨ ਉਹਨਾਂ ਨੂੰ ਮਿਲਦੀ ਹੈ ਠੀਕ ਹੈ ਪਰ ਪਚਵੰਜਾ ਤੱਕ ਵੀ ਅਸੀਂ ਪਿਛਲੇ ਸਾਲਾਂ ਦਾ ਜਿਵੇਂ ਦਾ ਰੁਝਾਨ ਵੇਖਿਆ ਕਿ ਪਚਵੰਜਾ ਪ੍ਰਸੈਂਟ ਵਾਲੇ ਬੱਚੇ ਨੂੰ ਵੀ ਐਡਮਿਸ਼ਨ ਐਟ ਦੀ ਐਂਡ ਹੋ ਜਾਂਦੀ ਹੈ ਭਾਵੇਂ ਦੂਜੀ ਜਾਂ ਤੀਜੀ ਲਿਸਟ 'ਚ ਉਹਦਾ ਨਾਮ ਆਵੇ ਇੱਕ ਲਿਸਟ ਲੱਗ ਜਾਂਦੀ ਹੈ ਬੱਚੇ ਟਾਈਮ ਦੱਸ ਦਿੱਤਾ ਜਾਂਦਾ ਇਸ ਦਿਨ ਨੂੰ ਲਿਸਟ ਲੱਗੇਗਾ ਉਹ 'ਚ ਆਪਣਾ ਨਾਮ ਵੇਖਣਾ ਆਪਾਂ ਠੀਕ ਹੈ ਆਪਣੇ ਕੋਲ ਦੋਵੇਂ ਆਪਸ਼ਨ ਅਵੇਲੇਬਲ ਨੇ ਚਾਹੇ ਪੰਜਾਬੀ ਲਿਟਰੇਚਰ ਹੈ ਤੁਸੀਂ ਆਪਣੇ ਇੰਟਰਸਟ ਦੇ ਅਕੋਡਿੰਗਲੀ ਮੈਂ ਤਾਂ ਕਵਾਂਗਾ ਕਿ ਤੁਸੀਂ ਹਾਂ ਤੁਸੀਂ ਦੋਵਾਂ 'ਚ ਤਿੰਨਾਂ 'ਚ ਚਾਰਾਂ 'ਚ ਕਿਸੇ 'ਚ ਵੀ ਅਪਲਾਈ ਕਰ ਸਕਦੇ ਹੋ ਇੱਕ ਜੋਗਰਫੀ ਹੁੰਦਾ ਉਹ ਆਪਣੀ ਬੀਏ 'ਚ ਪੜ੍ਹੀ ਜ਼ਰੂਰੀ ਚਾਹੀਦੀ ਹੈ ਵੈਸੇ ਬਾਕੀ ਪੰਜਾਬੀ ਜਾਂ ਇੰਗਲਿਸ਼ ਹੋ ਗਿਆ ਜਾਂ ਪੋਲੀਟੀਕਲ ਸਾਇੰਸ ਹੋ ਗਿਆ ਜਾਂ ਹਿਸਟਰੀ ਇਹ ਸਾਰਿਆਂ 'ਚ ਅਪਲਾਈ ਕਰ ਸਕਦੇ ਹੋ ਤੁਸੀਂ ਅਤੇ ਲਿਸਟ ਦੇ ਅਕੋਡਿੰਗਲੀ ਜਿਹੜੀ ਲਿਸਟ 'ਚ ਤੁਹਾਡਾ ਨਾਮ ਆਵੇਗਾ ਉਸ ਲਿਸਟ ਦੇ ਅਕੋਡਿੰਗਲੀ ਤੁਹਾਨੂੰ ਜਿਹੜੀ ਐਡਮਿਸ਼ਨ ਉਹ ਮਿਲ ਜੂਗੀ ਠੀਕ ਹੈ ਹਾਂ ਹਾਂ ਦੁਬਾਰਾ ਮੈਨੂੰ ਦੱਸ ਦਿਓ ਬੱਚੇ ਕੋਈ ਲੋੜ ਹੋਈ ਤਾਂ ਦੁਬਾਰਾ ਕਰ ਲਿਓ ਫੋਨ ਠੀਕ ਹੈ ਠੀਕ ਹੈ ਠੀਕ ਓਕੇ ਜੀ ਓਕੇ